ਮੁਸ਼ਕਿਲ ਪਕਵਾਨ ਹਨ ਜਿਵੇਂ ਕਿ ਪਨੀਰ ਕੁਲਚਾ ਪਨੀਰ ਵਾਲੇ ਨਾਨ ਗੁਜੀਆ ਪਕਵਾਨ ਕਬਾਬ ਇਹ ਮੈਨੂੰ ਬਹੁਤ ਮੁਸ਼ਕਿਲ ਲੱਗਦੇ ਹਨ ਬਣਾਉਣ ਵਿੱਚ ਮੈਂ ਸਿੱਖਣਾ ਚਾਹੁੰਦੀ ਹਾਂ ਪਨੀਰ ਵਾਲੇ ਨਾਨ ਇਹਨਾਂ ਵਿੱਚ ਮਸਾਲਾ ਭਰਦੀ ਹਾਂ ਪਰ ਮਸਾਲਾ ਭਰ ਨਹੀਂ ਹੁੰਦਾ ਪਨੀਰ ਪਤਾ ਨਹੀਂ ਕਿਵੇਂ ਖਿਲਰ ਜਾਂਦਾ ਹੈ